ਗਿਆਰਾਂ ਜਨਵਰੀ ਦੋ ਹਜ਼ਾਰ ਤੇਈ ਪੱਚੀ ਦਸੰਬਰ ਦੋ ਹਜ਼ਾਰ ਇੱਕੀ ਸਤਾਰਾਂ ਨਵੰਬਰ ਉੱਨੀ ਸੌ ਤ੍ਰਿਆਨਵੇਂ ਚੌਵੀ ਅਕਤੂਬਰ ਉੱਨੀ ਸੌੌ ਚੁਰੰਜਾ ਤੇਰਾਂ ਫਰਵਰੀ ਉੱਨੀ ਸੌ ਅਠਤਾਲ਼ੀ